ਅਸੀਂ ਪਿਛਲੇ ਸਮੇਂ ਗਰਮੀਆਂ ਦੇ ਵਿੱਚ ਛੁੱਟੀਆਂ ਦੇ ਵਿੱਚ ਬੱਚਿਆਂ ਦੇ ਨਾਲ ਮਨੀਕਰਣ ਸਾਹਿਬ ਜਾਣ ਦਾ ਪ੍ਰੋਗਰਾਮ ਮਨਾਲੀ ਜਾਣ ਦਾ ਪ੍ਰੋਗਰਾਮ ਬੱਚਿਆਂ ਨਾਲ ਬਣਾਇਆ ਤਾਂ ਕਿ ਅੰਮ੍ਰਿਤਸਰ 'ਚ ਉਸ ਵੇਲੇ ਗਰਮੀ ਬਹੁਤ ਹੁੰਦੀ ਹੈ ਜੂਨ ਜੁਲਾਈ ਦੀਆਂ ਛੁੱਟੀਆਂ ਦੇ ਵਿੱਚ ਪਹਾੜਾਂ ਦੇ ਉੱਤੇ ਘੁੰਮਣ ਦਾ ਵੱਖਰਾ ਹੀ ਆਨੰਦ ਆਉਂਦਾ ਹੈ ਜਦੋਂ ਉੱਥੇ ਦਾ ਮੌਸਮ ਥੋੜ੍ਹਾ ਠੰਡਾ ਹੋਣ ਕਰਕੇ ਸੋ ਅਸੀਂ ਵੀ ਆਪਣੇ ਪਰਿਵਾਰ ਦੇ ਨਾਲ ਅਤੇ ਆਪਣੇ ਸਹੁਰੇ ਪਰਿਵਾਰ ਨਾਲ ਮੈਂ ਆਪਣੀ ਫੈਮਲੀ ਬੱਚਿਆਂ ਨਾਲ ਮਿਸਿਜ਼ ਨਾਲ ਆਪਣੇ ਮਿਸਿਜ਼ ਦੀ ਸਿਸਟਰ ਉਹਦੇ ਹਸਬੈਂਡ ਅਤੇ ਉਹਦੇ ਬੱਚਿਆਂ ਨਾਲ ਅਤੇ ਹੋਰ ਪਰਿਵਾਰ ਦੇ ਨਾਲ ਅਸੀਂ ਆਪਣੀ ਕਾਰ ਦੇ ਉੱਤੇ ਵੱਡੀ ਕਾਰ ਦੇ ਉੱਤੇ ਜਾਣ ਦਾ ਉੱਪਰ ਇਕੱਠੇ ਪ੍ਰੋਗਰਾਮ ਬਣਾਇਆ ਫਿਰ ਅਸੀਂ ਇੱਥੇ ਸਭ ਤੋਂ ਪਹਿਲਾਂ ਅੰਮ੍ਰਿਤਸਰ ਤੋਂ ਚੱਲ ਕੇ ਅਨੰਦਪੁਰ ਸਾਹਿਬ ਗਏ ਅਨੰਦਪੁਰ ਸਾਹਿਬ ਜਾ ਕੇ ਉੱਥੇ ਹਿਸਟੋਰੀਕਲ ਗੁਰਦੁਆਰੇ ਜੋ ਕਿ ਸਿੱਖੀ ਨਾਲ ਸੰਬੰਧਿਤ ਨੇ ਮਹਾਰਾਜਾ ਸੋਰੀ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਸੰਬੰਧਿਤ ਗੁਰਦੁਆਰੇ ਦੀ ਯਾਤਰਾ ਕੀਤੀ ਦਰਸ਼ਨ ਕੀਤੇ ਉਸ ਤੋਂ ਬਾਅਦ ਅਸੀਂ ਹੋਰ ਗੁਰਦੁਆਰਿਆਂ ਦੀ ਯਾਤਰਾ ਕਰਦੇ ਹੋਏ ਅਸੀਂ ਪਾਹੜਾਂ ਦੇ ਵਿੱਚ ਹਿਮਾਚਲ ਰਵਾਲਸਰ ਸਾਹਿਬ ਗਏ ਉੱਥੇ ਰਾਤ ਬਿਤਾ ਕੇ ਯਾਤਰਾ ਕੀਤੀ ਬਹੁਤ ਹੀ ਮਨਮੋਹਕ ਦ੍ਰਿਸ਼ ਪਹਾੜਾਂ 'ਤੇ ਘੁੰਮਦੇ ਹੋਏ ਅਲੱਗ ਅਲੱਗ ਥਾਵਾਂ 'ਤੇ ਰਸਤੇ 'ਤੇ ਵੰਨ ਸੁਵੰਨੀਆਂ ਡੂੰਘੀਆਂ ਪਹਾੜੀ ਖਾਈਆਂ ਵਧੀਆ ਉੱਚੇ ਪਹਾੜਾਂ ਤੋਂ ਘੁੰਮਦੇ ਹੋਏ ਅੱਛੇ ਮੌਸਮ ਦੇ ਵਿੱਚ ਵਲ ਖਾਂਦੀਆਂ ਸੜਕਾਂ 'ਤੇ ਘੁੰਮਦੇ ਹੋਏ ਅਸੀਂ ਮਨਾਲੀ ਗਏ ਮਨਾਲੀ ਇੱਕ ਬਹੁਤ ਹੀ ਮਸ਼ਹੂਰ ਸਥਾਨ ਹੈ ਘੁੰਮਣ ਫਿਰਨ ਦਾ ਜਿੱਥੇ ਕਿ ਬਹੁਤ ਸਾਰੀ ਟੂਰਿਸਟ ਗਰਮੀ ਦੀਆਂ ਛੁੱਟੀਆਂ 'ਚ ਆਉਂਦੇ ਜਾਂਦੇ ਹਨ ਔਰ ਬਹੁਤ ਰਸ਼ ਹੁੰਦਾ ਹੈ ਉੱਥੇ ਔਰ ਉੱਥੋਂ ਦਾ ਬਰਫ਼ਬਾਰੀ ਕਰਕੇ ਠੰਡਾ ਮੌਸਮ ਗਰਮੀਆਂ ਦੇ ਵਿੱਚ ਹੁੰਦਾ ਹੈ ਜਿੱਥੇ ਕਿ ਲੋਕੀ ਆਪਣੀ ਗਰਮੀ ਤੋਂ ਰਾਹਤ ਪਾਉਣ ਲਈ ਪਹਾੜਾਂ ਦੇ ਵਿੱਚ ਸੈਰ ਕਰਨ ਜਾਂਦੇ ਹਨ ਜਿੱਥੇ ਕਿ ਬਹੁਤ ਹੀ ਵਧੀਆ ਸਪੋਰਟਸ ਈਵੈਂਟਸ ਅਤੇ ਹੋਰ ਥਾਵਾਂ ਦੇ ਉੱਤੇ ਜਾ ਕੇ ਤੁਸੀਂ ਟਰੈਕਿੰਗ ਵੀ ਕਰ ਸਕਦੇ ਹੋ ਤੁਸੀਂ ਉੱਥੇ ਪਹਾੜੀ ਚਸ਼ਮਿਆਂ ਦਾ ਆਨੰਦ ਮਾਣ ਸਕਦੇ ਹੋ ਕੁਦਰਤੀ ਝਰਨੇ ਔਰ ਕੁਦਰਤੀ ਦਰਿਆ ਪਹਾੜੀ ਜੋ ਕਿ ਜਿਨ੍ਹਾਂ ਦੇ ਵਿੱਚ ਰਾਫਟਿੰਗ ਦਾ ਆਨੰਦ ਲਿਆ ਜਾ ਸਕਦਾ ਹੈ ਸੋ ਅਸੀਂ ਵੀ ਆਪਣੇ ਪਰਿਵਾਰ ਦੇ ਨਾਲ ਬੱਚਿਆਂ ਦੇ ਨਾਲ ਬਹੁਤ ਸਾਰੇ ਯਾਤਰਾ 'ਤੇ ਘੁੰਮੇ ਔਰ ਉਹਨਾਂ ਨੂੰ ਬੱਚਿਆਂ ਨੂੰ ਬਹੁਤ ਹੀ ਆਨੰਦ ਆਇਆ ਜਿੱਥੇ ਕਿ ਅਸੀਂ ਵੀ ਆਪਣੇ ਚਾਰ ਦਿਨ ਛੁੱਟੀਆਂ ਬਹੁਤ ਵਧੀਆ ਤਰੀਕੇ ਨਾਲ ਬਿਤਾਈਆਂ ਅਲੱਗ ਅਲੱਗ ਇਲਾਕਿਆਂ ਦੇ ਵਿੱਚ ਪਹਾੜਾਂ 'ਚ ਘੁੰਮਦੇ ਹੋਏ ਬਹੁਤ ਹੀ ਆਨੰਦ ਬੱਚਿਆਂ ਨੇ ਔਰ ਅਸੀਂ ਵੀ ਪ੍ਰਾਪਤ ਕੀਤਾ ਪਹਾੜੀ ਖਾਣਿਆਂ ਦਾ ਪਹਾੜੀ ਮੌਸਮ ਦਾ ਪਹਾੜੀ ਇਲਾਕਿਆਂ ਦਾ ਵਿੱਚ ਘੁੰਮਣ ਦਾ ਇੱਕ ਆਪਣਾ ਹੀ ਮਜ਼ਾ ਹੈ ਜਿਸ ਦਾ ਕਿ ਅਸੀਂ ਬਹੁਤ ਹੀ ਆਨੰਦ ਮਾਣਿਆ